ਸਾਡੇ ਪਿੰਡ ਵਿੱਚ ਛੋਟੇ ਕਾਰੋਬਾਰ ਵਜੋਂ ਤੋਸ਼ੇ ਜੋਤੀ ਨੂੰ ਆਪਾਂ ਵਧਾ ਸਕਦੇ ਹਾਂ ਜਿਸ ਨੂੰ ਜਿਸ ਵਿੱਚ ਤੋਸ਼ੇ ਬਾਰੇ ਮੈਂ ਥੋੜ੍ਹੀ ਜਾਣਕਾਰੀ ਦੇਣਾ ਚਾਹਾਂਗਾ ਇਕ ਮਿਠਾਈ ਹੈ ਜੋ ਕਿ ਮੈਦੇ ਆਦਿ ਤੋਂ ਬਣਦੀ ਹੈ ਅਤੇ ਬਹੁਤ ਹੀ ਸੌਖੇ ਢੰਗ ਨਾਲ ਬਣਾਈ ਜਾ ਸਕਦੀ ਹੈ ਇਸ ਨੂੰ ਬਣਾਉਣ ਦਾ ਤਰੀਕਾ ਵੀ ਬੜਾ ਆਸਾਨ ਹੈ ਅਤੇ ਬਣਾਉਣ ਵਿੱਚ ਜ਼ਿਆਦਾ ਲਾਗਤ ਵੀ ਨਹੀਂ ਲਗਦੀ ਅਤੇ ਬਹੁਤ ਥੋੜ੍ਹੇ ਪੈਸੇ ਵਿੱਚ ਹੀ ਆਪਾਂ ਇਸ ਦੀ ਇਸ ਨੂੰ ਬਣਾ ਸਕਦੇ ਹਾਂ ਇਸ ਨੂੰ ਬਣਾਉਣ ਲਈ ਕੋਈ ਖਾਸ ਜਗ੍ਹਾ ਦੀ ਜ਼ਰੂਰਤ ਨਹੀਂ ਹੁੰਦੀ ਬਹੁਤ ਘੱਟ ਜਗ੍ਹਾ ਵਿੱਚ ਹੀ ਆਪਾਂ ਤੋਸ਼ੇ ਨੂੰ ਬਣਾ ਸਕਦੇ ਹਾਂ ਅਤੇ ਇਸ ਨੂੰ ਵੇਚ ਸਕਦੇ ਹਾਂ ਇਹ ਬਹੁਤ ਹੀ ਇੱਕ ਸਵਾਦਿਸ਼ਟ ਮਿਠਾਈ ਹੈ ਜਿਸ ਦੀ ਬਾਹਰ ਆਸ ਪਾਸ ਵੀ ਬਹੁਤ ਡਿਮਾਂਡ ਰਹਿੰਦੀ ਹੈ ਅਤੇ ਇਹ ਇੱਕ ਬਹੁਤ ਹੀ ਅੱਛਾ ਕਾਰੋਬਾਰ ਬਣ ਸਕਦਾ ਹੈ ਅਤੇ ਛੋਟੇ ਕਾਰੋਬਾਰ ਵਜੋਂ ਇੱਕ ਵਧੀਆ ਉਦਾਹਰਨ ਵੀ ਬਣ ਸਕਦਾ ਹੈ ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ ਇਹ ਮਿਠਾਈ ਪੰਜਾਬ ਹੀ ਨਹੀਂ ਬਲਕਿ ਵਿਸ਼ਵ ਪੱਧਰ 'ਤੇ ਵੀ ਇਸ ਨੂੰ ਪਹੁੰਚਾਇਆ ਜਾ ਸਕਦਾ ਹੈ